ਰੂਪਨਗਰ ਜ਼ਿਲ੍ਹੇ ਵਿੱਚ ਮੌਸਮ ਹੈ ਜਿਹੜਾ ਉਹ ਹਰ ਟਾਈਮ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਸਮੇਂ ਸਮੇਂ 'ਤੇ ਜਿਹੜਾ ਮੌਸਮ ਹੈ ਉਹ ਚੇਂਜ ਹੁੰਦਾ ਰਹਿੰਦਾ ਏ ਇਸਦੇ ਵਿੱਚ ਚਾਰ ਰੁੱਤਾਂ ਆਉਂਦੀਆਂ ਜਿਵੇਂ ਕਿ ਗਰਮੀ ਸਰਦੀ ਬਸੰਤ ਅਤੇ ਪੱਤਝੜ ਸਾਰੀਆਂ ਹੀ ਜਿਹੜੀਆਂ ਹੈ ਉਹ ਰੁੱਤਾਂ ਆਉਂਦੀਆ ਏ ਅਤੇ ਇਸ ਦੇ ਵਿੱਚ ਜ਼ਿਆਦਾਤਰ ਬਹੁਤ ਜ਼ਿਆਦਾ ਗਰਮੀ ਤਾਂ ਨਹੀਂ ਹੁੰਦੀ ਪਰ ਕਈ ਕਈ ਵਾਰ ਬਰਸਾਤ ਨਾ ਪੈਣ ਦੇ ਕਰਕੇ ਵਿੱਚ ਵਿੱਚ ਗਰਮੀ ਹੋ ਜਾਂਦੀ ਹੈ ਅਤੇ ਸਰਦੀਆਂ ਹੈ ਜਿਹੜੀਆਂ ਉਹ ਨਵੰਬਰ ਤੋਂ ਲੈ ਕੇ ਮਾਰਚ ਤੱਕ ਰਹਿੰਦੀਆਂ ਹਨ ਅਤੇ ਦਿਸੰਬਰ ਅਤੇ ਜਨਵਰੀ ਹੈ ਜਿਹੜੀ ਉਹ ਉਸ ਟਾਈਮ ਦੇ ਵਿੱਚ ਜ਼ਿਆਦਾ ਸਰਦੀ ਪੈਂਦੀ ਹੈ ਉਸ ਤੋਂ ਬਾਅਦ ਸਾਡੇ ਬਸੰਤ ਰੁੱਤ ਆ ਜਾਂਦੀ ਹੈ ਮਾਰਚ ਅਪ੍ਰੈਲ ਦੇ ਵਿੱਚ ਉਸ ਤੋਂ ਬਾਅਦ ਗਰਮੀ ਸਟਾਟ ਹੋ ਜਾਂਦੀ ਹੈ ਗਰਮੀਆਂ ਤੋਂ ਬਾਅਦ ਬਰਸਾਤ ਦੀ ਰੁੱਤ ਆ ਜਾਂਦੀ ਹੈ ਬਰਸਾਤਾਂ ਇਸ ਵਾਰ ਇਸ ਟਾਈਮ ਦੋ ਹਜ਼ਾਰ ਤੇਈ ਦੀ ਬਰਸਾਤ ਹੈ ਜਿਹੜੀ ਉਹ ਥੋੜ੍ਹੀ ਜ਼ਿਆਦਾ ਲੰਬੀ ਚੱਲਦੀ ਗਈ ਜਿਸ ਦੇ ਕਰਕੇ ਇਸ ਵਾਰ ਇੰਨੀ ਗਰਮੀ ਤਾਂ ਨਹੀਂ ਹੈ ਪਰ ਬਰਸਾਤ ਹੈ ਜਿਹੜੀ ਉਹ ਪੈ ਰਹੀ ਹੈ ਪੂਰੀ ਕਈ ਵਾਰ ਜੇਕਰ ਬਰਸਾਤ ਨਾ ਪਏ ਤਾਂ ਸੋਕਾ ਵੀ ਹੈ ਜਿਹੜਾ ਉਹ ਹੋ ਜਾਂਦਾ ਹੈ ਜਾਂ ਫਿਰ ਜ਼ਿਆਦਾ ਬਰਸਾਤ ਪੈਣ ਦੇ ਨਾਲ਼ ਹੜ੍ਹਾਂ ਦੀ ਸੰਭਵਨਾ ਵੀ ਹੋ ਜਾਂਦੀ ਹੈ ਸੋਕਾ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਹੜੀ ਜ਼ਮੀਨਾਂ ਹੈ ਫਸਲਾਂ ਉਹ ਨਹੀਂ ਹੋ ਪਾਉਂਦੀਆ ਸੋਕੇ ਦੇ ਕਰਕੇ ਜੋ ਹੈ ਬੋ ਮਿ ਮਿੱਟੀ ਹੈ ਜਿਹੜੀ ਉਸਦੀ ਤਰੇੜਾਂ ਫੱਟ ਜਾਂਦੀਆਂ ਹੈ ਅਤੇ ਜ਼ਿਆਦਾ ਜੇਕਰ ਜ਼ਿਆਦਾ ਮੀਂਹ ਪੈ ਜਾਏ ਤਾਂ ਹੜ੍ਹ ਆਉਣ ਦੀ ਸੰਭਵਨਾ ਹੋ ਜਾਂਦੀ ਹੈ ਫਸਲਾਂ ਜਿਵੇਂ ਕਿ ਹੁਣ ਜੀਰੀ ਧਾਨਾਂ ਦੀ ਫਸਲ ਚੱਲ ਰਹੀ ਹੈ ਉਹ ਹਲੇ ਲੱਗ ਰਹੀ ਹੈ ਜਿਸਦੇ ਕਰਕੇ ਇੱਕ ਦਮ ਜ਼ਿਆਦਾ ਮੀਂਹ ਪੈਣ ਦੇ ਨਾਲ਼ ਉਹ ਡੁੱਬ ਜਾਂਦੀ ਹੈ ਅਤੇ ਸੁੱਕ ਜਾਂਦੇ ਹਨ ਇਸ ਕਰਕੇ ਫਸਲਾਂ ਹੈ ਜਿਹੜੀਆਂ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ ਬਰਸਾਤ ਦੇ ਵਿੱਚ ਇਸ ਤੋਂ ਲ ਬਾਅਦ ਆਉਂਦੀ ਹੈ ਪਤ ਸਰਦੀਆਂ ਦੀ ਸਰਦੀਆਂ ਹੈ ਜਿਹੜੀਆਂ ਉਹ ਬਹੁਤ ਜ਼ਿਆਦਾ ਤਾਂ ਨਹੀਂ ਪੈਂਦੀ ਦਿਸੰਬਰ ਅਤੇ ਜਨਵਰੀ ਦੇ ਵਿੱਚ ਥੋੜ੍ਹੀ ਠੰਡ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਉਸ ਤੋਂ ਬਾਅਦ ਮੌਸਮ ਹੈ ਜਿਹੜਾ ਉਹ ਠੀਕ ਹੋ ਜਾਂਦਾ ਹੈ ਅਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖੀ ਹੈ ਸ ਮੈਂ ਚਾਰ ਦੀਆਂ ਚਾਰ ਰੁੱਤਾਂ ਹੈ ਜਿਹੜੀਆਂ ਉਹ ਅਨੁਭਵ ਕੀਤੀਆਂ ਅਤੇ ਮੇਰਾ ਅਨੁਭਵ ਠੀਕ ਰਿਹਾ ਹੈ ਬਹੁਤ ਜ਼ਿਆਦਾ ਕਠੋਰ ਗਰਮੀਆਂ ਜਾਂ ਬਹੁਤ ਜ਼ਿਆਦਾ ਕਠੋਰ ਸਰਦੀਆਂ ਹੈ ਜਿਹੜੀਆਂ ਉਹ ਮੈਂ ਅਨੁਭਵ ਨਹੀਂ ਕੀਤੀਆਂ ਮੌਸਮ ਹੈ ਜਿਹੜਾ ਉਹ ਰੋ ਰੂਪਨਗਰ ਜ਼ਿਲ੍ਹੇ ਦਾ ਉਹ ਠੀਕ ਹੈ ਸਿਹਤ ਦੇ ਅਨੁਕੂਲ ਹੈ